ਹੈਲੋ ਸਰ ਓਲਾ ਕੈਬ ਤੋਂ ਬੋਲ ਰਹੇ ਜੀ ਜੀ ਸਰ ਮੈਂ ਤਰਨਤਾਰਨ ਤੋਂ ਬੋਲ ਰਿਹਾਂ ਤਰਨਤਾਰਨ ਰੇਲਵੇ ਰੋਡ ਤੋਂ ਸਰ ਅੰਮ੍ਰਿਤਸਰ ਜਾਣਾ ਸੀਗਾ ਸਰ ਰੇਲਵੇ ਸਟੇਸ਼ਨ ਹਾਂਜੀ ਸਰ ਨੌ ਵਜੇ ਦਾ ਟਾਈਮ ਹੈ ਨੌ ਵਜੇ ਟ੍ਰੇਨ ਪਕੜਣੀ ਹੈ ਉੱਥੋਂ ਮੈਂ ਅਤੇ ਸਰ ਕਿੰਨੇ ਚਾਰਜਿਸ ਲਓਗੇ ਨਹੀਂ ਸਰ ਬਾਇਆ ਬਾਈਪਾਸ ਜਾਣਾ ਜੀ ਜੰਡਿਆਲਾ ਬਾਈਪਾਸ ਸਰ ਅਸੀਂ ਚਾਰ ਜਣੇ ਹਾਂ ਜੀ ਹਾਂਜੀ ਥੋੜ੍ਹਾ ਸਮਾਨ ਵੀ ਹੈਗਾ ਨਾਲ ਜੀ ਸਰ ਨਹੀਂ ਸਰ ਜਾਇਜ਼ ਜਾਇਜ਼ ਲਗਾਓ ਨਹੀਂ ਸਰ ਪੰਜ ਸੌ ਰੁਪਿਆ ਤਾਂ ਬਹੁਤ ਜ਼ਿਆਦਾ ਕਿਹੜੀ ਗੱਡੀ ਕਿਹੜੀ ਹੈ ਤੁਹਾਡੇ ਕੋਲ ਜੀ ਡਿਜਾਇਰ ਨਹੀਂ ਸਰ ਡਿਜਾਇਰ ਨਹੀਂ ਕੋਈ ਹੋਰ ਗੱਡੀ ਵੀ ਚੱਲੇਗੀ ਕੋਈ ਛੋਟੀ ਗੱਡੀ ਹੈ ਤਾਂ ਉਹ ਭੇਜ ਦਿਓ ਆਪਾਂ ਇੰਨੇ ਚਾਰਜਿਸ ਨਹੀਂ ਪੇਅ ਕਰਨੇ ਅਗਰ ਆਟੋ ਹੈ ਤਾਂ ਆਟੋ ਭੇਜ ਦਿਓ ਹਾਂਜੀ ਹਾਂਜੀ ਆਟੋ ਵੀ ਚਲੇਗਾ ਜੀ ਸਰ ਚਾਰ ਸਵਾਰੀਆਂ ਬਹਿ ਜਾਣਗੀਆਂ ਅਸੀਂ ਐਡਜਸਟ ਕਰ ਲਾਂਗੇ ਜੀ ਸਰ ਸਰ ਆਟੋ ਦੇ ਕਿੰਨੇ ਚਾਰਜਿਸ ਲਓਗੇ ਥ੍ਰੀ ਫਿਫਟੀ ਨਹੀਂ ਸਰ ਥ੍ਰੀ ਫਿਫਟੀ ਜ਼ਿਆਦਾ ਨੇ ਟੂ ਫਿਫਟੀ ਦੇਵਾਂਗੇ ਅਸੀਂ ਜੀ ਸਰ ਚਲੋ ਠੀਕ ਹੈ ਥ੍ਰੀ ਹੰਡਰਡ ਡਨ ਕਰਦੋ

ਸਰ ਰੇਲਵੇ ਰੋਡ ਤੋਂ ਤੁਸੀਂ ਆਉਣਾ ਹੈ ਜੰਡਿਆਲਾ ਰੋਡ 'ਤੇ ਫਾਟਕ ਤੋਂ ਲੈਫਟ ਹੋ ਕੇ ਜੀ ਸਰ ਬਸ ਥੋੜ੍ਹਾ ਜਿਹਾ ਸੌ ਕੁ ਗਜ਼ ਅੱਗੇ ਜਾ ਕੇ ਸਾਡਾ ਘਰ ਹੈਗਾ ਆ ਜੀ ਜੀ ਉੱਥੋਂ ਪਿੱਕ ਕਰਨਾ ਤੁਸੀਂ ਹਾਂਜੀ ਸਰ ਜੇ ਅਸੀਂ ਬਾਹਰ ਹੀ ਖੜ੍ਹੇ ਆ ਦੋ ਮਿੰਟ 'ਚ ਆ ਜਾਓ ਓਕੇ ਸਰ